ਮੇਰੇ ਸ਼ਹਿਰ ਵਿੱਚ ਹਫਤਾਵਾਰੀ ਸੰਧਾਈ ਆਯੋਜਿਤ ਕੀਤਾ ਜਾਂਦਾ ਹੈ ਮਤ ਐਤਵਾਰ ਵਾਲੇ ਦਿਨ ਹਫਤਾਵਾਰੀ ਸੰਧਾਈ ਆਯਜਿਤ ਹੁੰਦਾ ਹੈ ਉਸ ਦਿਨ ਸਾਰੇ ਲੋਕੀਂ ਬਾਜ਼ਾਰ ਵਿੱਚ ਜਾਂਦੇ ਹਨ ਉਸ ਤਰ੍ਹਾਂ ਹਰ ਨਵਾਂ ਨਵਾਂ ਸਮਾਨ ਦੇਖਣੇ ਨੂੰ ਮਿਲਦਾ ਹੈ ਅਤੇ ਸ ਸਸਤੇ ਰੇਟਾਂ ਵਿੱਚ ਮਿਲਦਾ ਹੈ ਉਸ ਦਿਨ ਸਾਰੇ ਲੋਕੀਂ ਸੰਡੇ ਵਾਲੇ ਦਿਨ ਫ੍ਰੀ ਹੁੰਦੇ ਹਨ ਅਤੇ